ਹੈਲੋ ਹਾਂਜੀ ਤੁਸੀਂ ਸੁਰਜੀਤ ਕੈਬ ਵਾਲੇ ਬੋਲ ਰਹੇ ਹੋ ਹਾਂਜੀ ਮੈਂ ਤੁਹਾਡੀ ਵਧੀਆ ਸਰਵਿਸ ਬਾਰੇ ਸੁਣਿਆ ਸੀ ਅਤੇ ਉਸ ਤੋਂ ਹੀ ਫੋਨ ਨੰਬਰ ਦੇਖ ਕੇ ਮੈਂ ਤੁਹਾਨੂੰ ਕਾਲ ਕੀਤੀ ਸੀ ਅਤੇ ਅਤੇ ਮੈਂ ਤੁਹਾਡੀ ਕੈਬ ਬੁੱਕ ਕਰਵਾਈ ਸੀ ਮੈਂ ਚੰਡੀਗੜ੍ਹ ਤੋਂ ਮਾਨਸਾ ਜਾਣਾ ਸੀ ਅਤੇ ਮੈਂ ਟਾਈਮਿੰਗ ਅੱਠ ਵਜੇ ਦੀ ਰੱਖੀ ਸੀ ਲੇਕਿਨ ਮੈਂ ਸੱਤ ਪੰਜਾਹ 'ਤੇ ਹੀ ਆ ਕੇ ਆਪਣੇ ਸਟੇਸ਼ਨ 'ਤੇ ਰੁਕ ਗਈ ਸੀ ਪਰ ਮੈਂ ਉਡੀਕ ਕਰ ਰਹੀ ਹਾਂ ਮੈਨੂੰ ਅੱਧਾ ਘੰਟਾ ਹੋ ਗਿਆ ਰੁਕੀ ਨੂੰ ਲੇਕਿਨ ਹਾਲੇ ਤੱਕ ਤੁਹਾਡੀ ਜਿਹੜੀ ਕੈਬ ਆ ਉਹ ਮੇਰੇ ਤੱਕ ਨਹੀਂ ਪਹੁੰਚੀ ਅਤੇ ਮੇਰਾ ਮਾਨਸਾ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਮੀਟਿੰਗ ਵੀ ਹੈ ਜਿਸ ਵਿੱਚ ਮੈਂ ਹਾਜ਼ਰ ਵੀ ਜ਼ਰੂਰ ਹੋਣਾ ਕਿਰਪਾ ਕਰਕੇ ਮੈਨੂੰ ਤੁਸੀਂ ਇਹ ਦੱਸ ਸਕਦੇ ਹੋ ਵੀ ਇੰਨਾ ਟਾਈਮ ਹੈ ਜਿਹੜਾ ਉਹ ਕਿਉਂ ਲੱਗ ਰਿਹਾ ਅਤੇ ਕਿੰਨੇ ਸਮੇਂ ਤੱਕ ਜਿਹੜੀ ਕੈਬ ਆ ਉਹ ਮੇਰੇ ਕੋਲ ਪਹੁੰਚ ਰਹੀ ਹੈ ਧੰਨਵਾਦ ਜੀ